ਬਚਪਨ ਵਿੱਚ ਸਾਡੇ ਪਿੰਡਾਂ ਦੇ ਵਿੱਚ ਕਾਫੀ ਖੇਡਾਂ ਜੋ ਕਿ ਮਸ਼ਹੂਰ ਸਨ ਜਿਹੜੀਆਂ ਬਚਪਨ ਦੀਆਂ ਖੇਡਾਂ ਹੁੰਦੀਆਂ ਹਨ ਅਸੀਂ ਵੀ ਉਹ ਖੇਡਦੇ ਰਹੇ ਹਾਂ ਜਿਨ੍ਹਾਂ ਵਿੱਚ ਲੁਕਣ ਮਿਚੀ ਪਿੱਠੂ ਗੇਮ ਪੀਚੋ ਆਪਣੇ ਛੂਹਣ ਛਲਾਕਾ ਅਤੇ ਇੱਕ ਹੈਗਾ ਗੁੱਲੀ ਡੰਡਾ ਜੀ ਗੁੱਲੀ ਡੰਡਾ ਵੀ ਇੱਕ ਵਧੀਆ ਗੇਮ ਹੈਗੀ ਆ ਬਚਪਨ ਦੀ ਗੇਮ ਹੈ ਗੋਲੇ ਖੇਡਣੇ ਬੰਟੇ ਖੇਡਣੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ ਅਤੇ ਲੁਕਣ ਮਿਚੀ ਮੈਂ ਬਹੁਤ ਖੇਡਦਾ ਰਿਹਾ ਆਪਣੇ ਬਚਪਨ ਦੇ ਵਿੱਚ ਆਪਣੇ ਸਾਥੀਆਂ ਨਾਲ ਉਹਦੇ ਉਹਦਾ ਜਿਹੜਾ ਮੇਨ ਰੂਲ ਨਿਯਮ ਹੁੰਦੇ ਸਨ ਉਹਦੇ ਵਿੱਚ ਇੱਕ ਬੰਦੇ ਨੇ ਵਾਰੀ ਦੇਣੀ ਹੁੰਦੀ ਆ ਅਤੇ ਬਾਕੀ ਜਿੰਨੇ ਵੀ ਹੁੰਦੇ ਆ ਉਹਨਾਂ ਨੇ ਸਾਰਿਆਂ ਨੇ ਲੁਕਣਾ ਹੁੰਦਾ ਆ ਅਤੇ ਜਿਹਦੇ ਵਿੱਚੋਂ ਸਭ ਤੋਂ ਪਹਿਲਾਂ ਜਿਹੜਾ ਲੱਭ ਲਿਆ ਲਿਆ ਜਾਂਦਾ ਸੀ ਉਹ ਉਹ ਉਹ ਬੰਦੇ ਨੇ ਫੇਰ ਉਹਦੀ ਦੁਬਾਰਾ ਵਾਰੀ ਆ ਜਾਂਦੀ ਸੀ ਜੇਕਰ ਉਹ ਜਿਹੜਾ ਬੰਦਾ ਲੱਭ ਰਿਹਾ ਹੁੰਦਾ ਹੈ ਅਤੇ ਲੱਭਦਾ ਲੱਭਦਾ ਕਿਸੇ ਨੂੰ ਲੁਕਣ ਵਾਲੇ ਨੂੰ ਜੇਕਰ ਉਹਨੂੰ ਆ ਕੇ ਉਹ ਧੱਫਾ ਕਹਿ ਦਿੰਦਾ ਸੀ ਤਾਂ ਉਹਨੂੰ ਦੁਬਾਰਾ ਵਾਰੀ ਦੇਣੀ ਪੈ ਜਾਂਦੀ ਸੀਗੀ